ਭਾਰਤ ਵਿੱਚ ਜੇ ਮੈਂ ਪੰਜਾਬ ਰਾਜ ਦੀ ਗੱਲ ਕਰਾਂ ਤਾਂ ਪੰਜਾਬ ਵਿੱਚ ਕੁੱਛ ਸਮਾਂ ਪਹਿਲਾਂ ਤੋਂ ਪਹਿਰਾਵੇ ਵਿੱਚ ਬਹੁਤ ਹੀ ਜ਼ਿਆਦਾ ਤਬਦੀਲੀ ਆਈ ਹੈ ਜੋ ਕਿ ਨਿੰਦਣਯੋਗ ਹੈ ਪੰਜਾਬ ਦਾ ਅਸਲੀ ਮੂਲ ਪਹਿਰਾਵਾ ਮੁੰਡਿਆਂ ਲਈ ਕੁੜਤਾ ਅਤੇ ਚਾਦਰਾ ਕੁੜੀਆਂ ਲਈ ਸਲਵਾਰ ਕਮੀਜ਼ ਹੈ ਜੋ ਕਿ ਦਿਨੋਂ ਦਿਨ ਆਉਣ ਵਾਲੀ ਪੀੜ੍ਹੀ ਭੁੱਲਦੀ ਜਾ ਰਹੀ ਹੈ ਅਤੇ ਨਵੇਂ ਫੈਸ਼ਨ ਵੱਲ ਧਿਆਨ ਦੇਈ ਦੇ ਰਹੀ ਹੈ ਅਤੇ ਉਹੀ ਅਪਣਾ ਰਹੀ ਹੈ ਇਸ ਕਰਕੇ ਸਾਨੂੰ ਇਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਆਪਣੇ ਕਲਚਰ ਨੂੰ ਅਲੋਪ ਨਾ ਹੋਣ ਦੇਈਏ ਅਤੇ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਦੇਈਏ ਇਹ ਸਾਡਾ ਪਹਿਰਾਵਾ ਹੈ ਇਹ ਸਾਡਾ ਖਾਣ ਪੀਣ ਹੈ ਜੋ ਕਿ ਸਾਡੀਆਂ ਇਹ ਕਲਾ ਸ਼ੈਲੀਆਂ ਹਨ ਇਹਨਾਂ ਨੂੰ ਹੀ ਸੰਭਾਲ ਕੇ ਰੱਖਣਾ ਚਾਹੀਦਾ ਹੈ